ਹਾਂ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਕਿਉਂਕਿ ਮੈਂ ਇੱਕ ਅਧਿਆਪਕ ਹਾਂ ਜੇ ਬਿਜਲੀ ਦਾ ਕੱਟ ਲੱਗ ਵੀ ਜਾਵੇ ਤਾਂ ਸਕੂਲ ਵਿੱਚ ਪੜ੍ਹਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਗਰਮੀਆਂ ਵਿੱਚ ਲਾਈਟ ਅਤੇ ਪੱਖੇ ਬੰਦ ਹੋ ਜਾਂਦੇ ਹਨ ਅਤੇ ਕਮਰਿਆਂ ਵਿੱਚ ਹਨੇਰਾ ਹੋ ਜਾਂਦਾ ਅਤੇ ਜਿਸ ਕਾਰਣ ਬੱਚਿਆਂ ਨੂੰ ਪੜ੍ਹਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਟੀਚਰਾਂ ਨੂੰ ਵੀ ਹਨੇਰੇ ਵਿੱਚ ਪੜ੍ਹਾਉਣਾ ਮੁਸ਼ਕਿਲ ਹੋ ਜਾਂਦਾ ਹੈ ਜਦ ਲਾਈਟਸ ਬੰਦ ਹੋ ਜਾਂਦੀਆਂ ਤਾਂ ਅਸੀਂ ਖਿੜਕੀਆਂ ਖੋਲਦੇ ਹਾਂ ਅਤੇ ਥੋੜ੍ਹੀ ਬਹੁਤ ਰਾਹਤ ਮਹਿਸੂਸ ਕਰਦੇ ਹਾਂ ਪਰ ਕਮਰੇ ਵਿੱਚ ਹਾਂ ਇੱਥੇ ਲੋਕਾਂ ਕੋਲੋਂ ਇਨਵਰਟਰ ਹੈਗੇ ਨੇ ਅਤੇ ਲੋਕ ਇਨਵਰਟਰ ਚਲਾ ਕੇ ਗੁਜ਼ਾਰਾ ਕਰਦੇ ਹਨ ਧੰਨਵਾਦ